ਨਵਾਂ ਜੰਮਿਆ ਬੱਚਾ ਗੁਲਾਬ ਦੇ ਫੁੱਲ ਵਰਗਾ ਹੁੰਦਾ ਹੈ ਬਹੁਤ ਹੀ ਨਾਜ਼ੁਕ ਹੁੰਦਾ ਹੈ ਉਸਦੀ ਕੇਅਰ ਕਰਨਾ ਬਹੁਤ ਜ਼ਰੂਰੀ ਹੁੰਦੀ ਹੈ ਉਸਦਾ ਪੂਰੀ ਤਰੀਕੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਅਤੇ ਖਿਆਲ ਰੱਖਣ ਲਈ ਅਤੇ ਉਸ ਨੂੰ ਤੰਦਰੁਸਤ ਅਤੇ ਉਹਦੀ ਸਿਹਤ ਦਾ ਖਿਆਲ ਰੱਖਦੇ ਖਿਆਲ ਰੱਖਦਿਆਂ ਹੋਇਆਂ ਸਾਨੂੰ ਸਭ ਤੋਂ ਪਹਿਲਾਂ ਉਸ ਦਾ ਵਾਤਾਵਰਨ ਸਵੱਛ ਰੱਖਣਾ ਚਾਹੀਦਾ ਹੈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਵਾਤਾਵਰਨ ਵਿੱਚ ਕੋਈ ਵੀ ਤਰ੍ਹਾਂ ਦਾ ਕੀੜਾ ਜਿਵੇਂ ਮੱਛਰ ਮੱਖੀ ਬਿਲਕੁਲ ਨਾ ਹੋਣ ਤਾਂ ਕਿ ਬੱਚੇ ਨੂੰ ਕੋਈ ਵੀ ਇਨਫੈਕਸ਼ਨ ਨਾ ਦੇ ਸਕਣ ਅਤੇ ਦੇਖਿਆ ਜਾਏ ਕਿ ਜੋ ਵੀ ਬੱਚੇ ਨੂੰ ਗੋਦ ਵਿੱਚ ਲੈ ਰਿਹਾ ਹੈ ਉਹ ਪਹਿਲਾਂ ਚੰਗੀ ਤਰ੍ਹਾਂ ਹੱਥ ਧੋ ਕੇ ਖੁਦ ਨੂੰ ਸੈਨਾਟਾਈਜ ਕਰਕੇ ਫਿਰ ਹੀ ਬੱਚੇ ਨੂੰ ਆਪਣੀ ਗੋਦ ਵਿੱਚ ਉਠਾਏ ਅਤੇ ਧਿਆਨ ਰੱਖਿਆ ਜਾਏ ਕਿ ਬੱਚੇ ਦੇ ਡਾਇਪਰ ਕੱਪੜੇ ਅਤੇ ਆਦਿ ਵਰਤਿਆ ਜਾਣ ਵਾਲਾ ਸਮਾਨ ਡਟੋਲ ਵਿੱਚ ਧੁਖਿਆ ਹੋਵੇ ਅਤੇ ਸਾਫ ਹੱਥਾਂ ਨਾਲ ਰੱਖਿਆ ਗਿਆ ਹੋਵੇ ਬੱਚੇ ਬੱਚੇ ਦਾ ਬਿਸਤਰ ਵੀ ਹਮੇਸ਼ਾ ਸਾਫ ਰਹਿਣਾ ਚਾਹੀਦਾ ਹੈ ਤਾਂ ਕਿ ਉਸਨੂੰ ਕੋਈ ਵੀ ਪ੍ਰਕਾਰ ਦੀ ਇੰਨਫੈਕਸ਼ਨ ਨਾ ਹੋ ਸਕੇ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਬੱਚੇ ਨੂੰ ਨੂੰ ਸਵੱਛ ਵਾਤਾਵਰਨ ਵਿਚ ਰੱਖਾਂਗੇ ਜਿਸ ਕਰਕੇ ਬੱਚਾ ਕਿਸੇ ਵੀ ਤਰ੍ਹਾਂ ਦੀ ਇੰਨਫੈਕਸ਼ਨ ਦੀ ਚਪੇਟ ਵਿੱਚ ਨਹੀਂ ਆਵੇਗਾ ਅਤੇ ਤੰਦਰੁਸਤ ਰਹੇਗਾ ਨਵ ਜੰਮੇ ਬੱਚੇ ਦੀ ਕੇਅਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ